ਅੱਛਾ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਭੈਣ ਜੀ ਮੈਂ ਐਥੇ ਆਈ ਹਾਂ ਅਤੇ ਨਾ ਮੈਨੂੰ ਸਬਜ਼ੀਆਂ ਬਾਰੇ ਨੋਲਜ ਨਹੀਂ ਤਾਜ਼ੀਆਂ ਸਬਜ਼ੀਆਂ ਮੈਂ ਕਿਧਰੇ ਅਸੀਂ ਮਟਰ ਲੈਂਦੇ ਬਹੁਤ ਖ਼ਰਾਬ ਨਿਕਲੇ ਜੀ ਉਹ ਅਤੇ ਅਸੀਂ ਨਵੇਂ ਸ਼ਿਫਟ ਹੋਏ ਆ ਮੈਨੂੰ ਪਤਾ ਨਹੀਂ ਜੀ ਤੁਹਾਡੇ ਗਵਾਂਢ ਹੀ ਹਾਂ ਹਾਂਜੀ ਹਾਂ ਹਾਂ ਨਹੀਂ ਤੁਹਾਡੇ ਤੁਹਾਡੇ ਗੁਆਂਢ ਹੀ ਹਾਂ ਮੈਂ ਤਾਂ ਤੁਹਾਨੂੰ ਦੇਖਿਆ ਜੀ ਅੱਗੇ ਕਿਤੇ ਹਾਂਜੀ ਅਤੇ ਮੈਨੂੰ ਤਾਂ ਨਾ ਕੋਈ ਨੌਲਜ ਨਹੀਂ ਹੈਗੀ ਵੀ ਤੁਹਾਨੂੰ ਤਾਂ ਤੁਸੀਂ ਤਾਂ ਨਵੇਂ ਆਏ ਹਾਂ ਅੱਗੇ ਪਤਾ ਨਹੀਂ ਕਿੱਥੋਂ ਆਏ ਲੈ ਨੇ ਬਹੁਤ ਮਟਰ ਖ਼ਰਾਬ ਨਿਕਲੇ ਨੇ ਅਤੇ ਹੁਣ ਨਾ ਮੈਂ ਤੁਹਾਡੇ ਨਾਲ ਹੀ ਤੁਸੀਂ ਮੈਨੂੰ ਲੈ ਕੇ ਚੱਲੋ ਤਾਜ਼ੀਆਂ ਸਬਜ਼ੀਆਂ ਕਿੰਨੀਆਂ ਦੁਕਾਨ 'ਤੇ ਨਾ ਫਿਰ ਨਾਲ ਚੱਲਿਆ ਕਰੋ ਹੈਂ ਠੀਕ ਆ ਠੀਕ ਅੱਛਾ ਹਾਂਜੀ ਹਾਂਜੀ

ਠੀਕ ਹੈ ਜੀ ਤੁਸੀਂ ਐਂਉਂ ਕਰਿਆ ਕਰੋ ਤੁਸੀਂ ਜਾਣਾ ਅਤੇ ਮੈਨੂੰ ਨਾਲ ਲੈ ਕੇ ਸਵੇਰੇ ਜੇ ਤੁਸੀਂ ਚਾਹੁੰਦੇ ਮੰਡੀ 'ਚ ਜਾਣਾ ਮਿਲ ਜਾਂਦੀਆਂ ਹਾਂਜੀ ਅੱਛਾ ਜੀ ਕੋਈ ਨਹੀਂ ਆਪਾਂ ਚਲੇ ਜਾਵਾਂਗੇ ਹੈਂ ਆਦੇ ਨਹੀਂ ਜੀ ਮੈਂ ਡੈਡੀ ਨੂੰ ਭੇਜ ਦਿਆਂਗੀ ਮੈਂ ਨਹੀਂ ਜਦੋਂ ਤੁਸੀਂ ਜਾਣਾ ਮੈਨੂੰ ਦੱਸ ਦਿਆ ਜੀ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਜੀ ਆਪਾਂ ਨੂੰ ਸਾਰੀ ਚਾਹੀਦੀਆਂ ਭੈਣ ਜੀ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਜੀ ਪਾਣੀ ਤੁਸੀਂ ਮੈਨੂੰ ਲੈਣਾ ਤੁਸੀਂ ਮੈਨੂੰ ਨਾਲ ਲੈ ਜਾਣਾ ਤੁਸੀਂ ਮੈਨੂੰ ਨਾਲ ਲੈ ਜਾਣਾ ਠੀਕ ਹੈ ਜੀ ਹਾਂਜੀ ਨਹੀਂ ਨਹੀਂ ਲੇਟ ਨਹੀਂ ਕਰਦੀ ਕੋਈ ਨਹੀਂ ਆਹੋ ਮੈਂ ਕਿਹਾ ਤੁਹਾਨੂੰ ਸਬਜ਼ੀਆਂ ਦੀ ਨੌਲਜ ਹੈ ਪਰ ਹਾਂ ਹਾਂਜੀ ਠੀਕ ਹੈ ਜੀ ਕੋਈ ਨਹੀਂ ਪਹਿਲਾਂ ਤੁਸੀਂ ਮੈਨੂੰ ਨਾਲ ਲੈ ਕੇ ਜਾਇਆ ਕਰਿਆ ਜੇ ਠੀਕ ਆ ਜੀ ਮੈਂ ਤੁਹਾਨੂੰ ਤਾਂ ਪਤਾ ਜਲੰਧਰ ਰਹਿੰਦੇ ਸੀ ਜੀ ਪਹਿਲਾਂ ਭੈਣ ਜੀ ਅਸੀਂ ਐਧਰੋ ਹਾਂਜੀ ਮਕਾਨ ਕਿਰਾਏ 'ਤੇ ਸੀ ਜੀ ਹਾਂਜੀ ਅਤੇ ਹੁਣ ਮਤਲਬ ਅਸੀਂ ਨਾ ਇਥੇ ਸ਼ਿਫਟ ਹੋਏ ਨਾ ਹੁਣ ਫਿਰ ਬੇਗਾਨੇ ਸ਼ਹਿਰ ਦਾ ਪਤਾ ਨਹੀਂ ਲੱਗਦਾ ਭੈਣ ਜੀ ਵੀ ਕਿੱਥੋਂ ਚੀਜ਼ ਮਿਲਦੀ ਹੈ

ਹਾਂਜੀ ਫਿਰ ਮੈਂ ਚਾਰ ਵਜੇ ਆ ਜਾਵਾਂ ਜੀ ਅਤੇ ਕੱਲ੍ਹ ਨੂੰ ਆਪਾਂ ਕਿੰਨੇ ਵਜੇ ਜਾਣਾ ਫਿਰ ਜੀ ਅੱਛਾ ਜੀ ਫਿਰ ਮੈਂ ਤਿਆਰ ਹੋ ਕੇ ਆ ਜਾਵਾਂਗੀ ਨਹੀਂ ਨਹੀਂ ਟਾਈਮ ਤਾਂ ਪੱਕਾ ਕਰ ਲੈਣਾ ਜੀ ਤੁਹਾਨੂੰ ਪਤਾ ਜੀ ਫਿਰ ਆਉਣਾ ਕੱਪੜੇ ਤਾਂ ਪਾਉਣੀ ਹੀ ਆ ਬਸ ਤਿਆਰ ਹੋ ਕੇ ਫਿਰ ਹੀ ਆਉਣਾ ਹਾਂਜੀ ਠੀਕ ਹੈ ਜੀ ਆ ਜਾਓ ਫਿਰ ਆਪਾਂ ਚਾਹ ਪਾਣੀ ਪੀਓ ਪੀਂਦੇ ਹਾਂਜੀ ਹਾਂਜੀ ਧੰਨਵਾਦ ਜੀ ਹਾਂਜੀ ਹਾਂਜੀ ਸਾਡਾ ਘਰ ਵੀ ਪਿੱਛੇ ਆ ਜੀ ਹਾਂਜੀ ਹਾਂ ਹਾਂਜੀ

ਹਾਂਜੀ ਹਾਂਜੀ ਹਾਂ ਠੀਕ ਹੈ ਜੀ ਆ ਜਾਓ ਅੱਛਾ ਅੱਛਾ ਜੀ ਠੀਕ ਹੈ ਜੀ ਅੱਛਾ ਅੱਛਾ ਠੀਕ ਆ ਜੀ ਕੋਈ ਨਹੀਂ ਮੈਂ ਪਹਿਲਾਂ ਵੇਖ ਲੈਂਦੀ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਠਾਕ ਜੀ